ਨੌਜਵਾਨਾਂ ਦੇ ਵਿੱਚ ਬੇਰੁਜ਼ਗਾਰੀ ਦਾ ਮਸਲਾ ਅੱਜ ਇੱਕ ਬੇਹੱਦ ਵੱਡਾ ਮਸਲਾ ਬਣ ਗਿਆ ਜਿਵੇਂ ਸਾਡੇ ਨੌਜਵਾਨ ਪੰਜਾਬ ਛੱਡ ਕੇ ਪ੍ਰਵਾਸ ਕਰ ਰਹੇ ਹੈ ਇਹ ਵੀ ਬੇਰੁਜ਼ਗਾਰੀ 'ਚੋਂ ਨਿਕਲੀ ਹੋਈ ਇੱਕ ਅਲਾਮਤ ਹੈ ਇਸੇ ਤਰ੍ਹਾਂ ਜੋ ਸਾਡੇ ਪਿੰਡਾਂ ਵਿੱਚ ਖਾਸ ਕਰਕੇ ਅਤੇ ਸ਼ਹਿਰਾਂ ਵਿੱਚ ਵੀ ਬੇਸ਼ੱਕ ਬਹੁਤ ਹੈ ਅੱਜ ਕੱਲ੍ਹ ਬਹੁਤ ਜ਼ਿਆਦਾ ਮਾਰੂ ਚਿੱਟੇ ਵਰਗੇ ਨਸ਼ੇ ਗੋਲੀਆਂ ਕੈਪਸੂਲ ਵਗੈਰਾ ਜੋ ਨੌਜਵਾਨ ਇੱਥੋਂ ਤੱਕ ਕਿ ਲੜਕੀਆਂ ਵੀ ਵਰਤ ਰਹੇ ਆ ਇਹ ਵੀ ਬੇਰੁਜ਼ਗਾਰੀ 'ਚੋਂ ਨਿਕਲਿਆ ਹੋਇਆ ਇੱਕ ਕਾਰਨ ਹੈ ਉਹਨਾਂ ਦਾ ਨਿਰਾਸ਼ਤਾ ਵਿੱਚੋਂ ਉਹ ਇਸ ਪਾਸੇ ਧੱਕੇ ਜਾਂਦੇ ਆ ਸਰਕਾਰਾਂ ਦਾ ਇਸ ਪਾਸੇ ਵੱਲ ਧਿਆਨ ਹੋਣਾ ਚਾਹੀਦਾ ਕਿ ਉਹਨਾਂ ਨੂੰ ਸਵੈ ਸ਼ਿਕਸ਼ਿਤ ਕਰਕੇ ਉਹਨਾਂ ਲਈ ਰੁਜ਼ਗਾਰ ਦੇ ਸੋਮੇ ਪੈਦਾ ਕਰਕੇ ਘਰਾਂ ਦੇ ਵਿੱਚ ਛੋਟੀ ਇੰਡਸਟਰੀ ਲਾ ਕੇ ਜਿਵੇਂ ਕਿਸੇ ਸਮੇਂ ਉਣੰਜਾ ਤੋਂ ਬਾਅਦ ਚੀਨ ਦੇ ਵਿੱਚ ਉੱਥੋਂ ਦੀ ਸਰਕਾਰ ਨੇ ਲੋਕਾਂ ਨੂੰ ਛੋਟੀ ਇੰਡਸਟਰੀ ਦਿੱਤੀ ਅੱਜ ਉਹਦਾ ਸਿੱਟਾ ਇਹ ਹੈ ਕਿ ਚੀਨ ਦੇ ਜਿਹੜੇ ਸਟੋਕ ਹੈ ਉਹ ਮਾਲ ਨਾਲ ਭਰੇ ਹੋਏ ਹੈ ਅਤੇ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਬੇਸ਼ੱਕ ਉਹਨੂੰ ਵੇਚ ਦੇਣ ਲਈ ਸੰਸਾਰ ਪੱਧਰ 'ਤੇ ਮੰਡੀ ਦੀ ਭਾਲ ਵਿੱਚ ਚੀਨ ਲੱਗਿਆ ਹੋਇਆ ਇਸੇ ਤਰ੍ਹਾਂ ਸਾਡੇ ਹਿੰਦੁਸਤਾਨ ਨੂੰ ਇੱਕ ਸੁਪਰ ਪਾਵਰ ਬਣਾਉਣ ਦਾ ਸੁਪਨਾ ਦੇਖਣ ਵਾਲੀਆਂ ਸਰਕਾਰਾਂ ਇਹ ਕਰਨ ਹਰ ਇੱਕ ਨੂੰ ਰੁਜ਼ਗਾਰ ਦੇਣ ਜੋ ਨਸ਼ੇ ਗੈਰ ਕਾਨੂੰਨੀ ਤੌਰ 'ਤੇ ਵਿਕ ਰਹੇ ਆ ਅਤੇ ਸਾਡੇ ਨੌਜਵਾਨਾਂ ਨੂੰ ਇਹ ਅਲਾਮਤ ਲਾਈ ਜਾ ਰਹੀ ਹੈ ਉਸ ਤੋਂ ਛੁਟਕਾਰਾ ਪਾਉਣ ਵਾਸਤੇ ਇਹਦੀਆਂ ਮੁੱਢਲੀਆਂ ਤੰਦਾਂ ਜਿੱਥੋਂ ਇਹ ਤਿਆਰ ਹੋ ਕੇ ਲੋਕਾਂ ਦੇ ਵਿੱਚ ਪਹੁੰਚਦੇ ਆ ਉੱਥੇ ਰੋਕਾਂ ਲਾਈਆਂ ਜਾਣ ਉਥੋਂ ਇਹ ਸਾਡੇ ਲੋਕਾਂ ਵਿੱਚ ਆਉਣਾ ਹੀ ਨਾ ਕਿਸੇ ਸਮੇ ਛੋਟੇ ਨਸ਼ੇ ਜਿਵੇਂ ਭੁੱਕੀ ਜਾਂ ਅਫੀਮ ਵਗੈਰਾ ਵੀ ਹੁੰਦੇ ਸੀ ਇਹਨਾਂ ਦਾ ਕੋਈ ਮਾਰੂ ਸਿੱਟਾ ਅੱਜ ਤੱਕ ਅਸੀਂ ਨਹੀਂ ਵੇਖਿਆ ਪਿਛਲੇ ਸਮਿਆਂ 'ਚ ਜਿਹੜੇ ਪਿੰਡਾਂ ਵਿੱਚ ਇਹੋ ਜਿਹੇ ਲੋਕ ਇਹਨਾਂ ਨਸ਼ਿਆਂ ਨੂੰ ਵਰਤਦੇ ਸੀ ਉਹਨਾਂ ਨੂੰ ਵੱਧ ਤੋਂ ਵੱਧ ਬਸ ਅਮਲੀ ਕਹਿ ਦਿੱਤਾ ਜਾਂਦਾ ਸੀ ਪਰ ਉਹਨਾਂ ਦੀ ਸਿਹਤ ਅਤੇ ਉਹਨਾਂ ਦੇ ਆਰਥਿਕ ਜੀਵਨ 'ਤੇ ਉਹਨਾਂ ਦੇ ਸਮਾਜਿਕ ਜੀਵਨ 'ਤੇ ਕਦੇ ਕੋਈ ਲੰਬਾ ਚੌੜਾ ਅਸਰ ਨਹੀਂ ਦੇਖਿਆ ਅੱਜ ਜਿਹੜੇ ਨਸ਼ੇੜੀ ਹੈ ਉਹ ਸਮਾਜ ਨਾਲੋਂ ਕੱਟੇ ਜਾ ਚੁੱਕੇ ਆ ਜਿਹੜੇ ਕਿ ਸਿਰਫ ਅਤੇ ਸਿਰਫ ਬੇਰੁਜ਼ਗਾਰੀ ਦਾ ਸਿੱਟਾ ਇਸ ਕਰਕੇ ਸਰਕਾਰਾਂ ਨੂੰ ਰੁਜ਼ਗਾਰ ਵੱਲ ਸਭ ਤੋਂ ਪਹਿਲਾਂ ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਲੋਕਾਂ ਨੂੰ ਪੜ੍ਹਨ ਲਿਖਣ ਤੋਂ ਬਾਅਦ ਸਿਰਫ ਸਰਕਾਰੀ ਨੌਕਰੀ ਦਫ਼ਤਰ ਵਿੱਚ ਬੈਠ ਕੇ ਕਾਗਜ਼ 'ਤੇ ਲਕੀਰਾਂ ਮਾਰਨੀਆਂ ਇਸੇ ਨੂੰ ਰੁਜ਼ਗਾਰ ਦਾ ਨਾਂ ਦਿੱਤਾ ਹੋਇਆ ਅਤੇ ਰੁਜ਼ਗਾਰ ਇਹ ਮੁੱਖ ਲੋਕਾਂ ਦੇ ਵਿੱਚ ਧਾਰਨਾ ਹੈ ਪਰ ਇਸ ਤੋਂ ਅੱਗੇ ਵੱਧ ਕੇ ਕਾਰੋਬਾਰ ਕਰਨੇ ਕਾਰੋਬਾਰਾਂ ਨੂੰ ਚਲਾਉਣਾ ਕਾਰੋਬਾਰ ਸੈਟ ਅਪ ਕਰਨੇ ਇਹ ਸਾਰਾ ਕੁਝ ਰੁਜ਼ਗਾਰਾਂ ਦੇ ਵਿੱਚ ਸਰਕਾਰਾਂ ਧਿਆਨ ਦੇਣ